ਮੈਂ ਪਹਿਲਾਂ ਵੀ ਖੇਤੀਬਾੜੀ ਨਾਲ ਸੰਬੰਧਿਤ ਰੱਖਦਾ ਹਾਂ ਅਤੇ ਅਸੀਂ ਪਹਿਲਾਂ ਵੀ ਖੇਤੀ ਜਿਵੇਂ ਫਸਲ ਉਗਾਉਣੀ ਕਣਕ ਜੌਂ ਮੱਕੀ ਉਹ ਵੀ ਫਸਲਾਂ ਉਗਾਉਂਦੇ ਹਾਂ ਪਰ ਬਾਅਦ ਦੇ ਵਿੱਚ ਮੇਰੇ ਦੋਸਤ ਨੇ ਮੈਨੂੰ ਇੱਕ ਸਲਾਹ ਦਿੱਤੀ ਕਿ ਤੁਸੀਂ ਬੂਟੇ ਕਿਵੇਂ ਫੁੱਲ ਬਾਗਬਾਨੀ ਤਿਆਰ ਕਰੋ ਜਿਸ ਦੇ ਵਿੱਚ ਸਾਬ ਬੂਟਿਆਂ ਦੇ ਵਿੱਚ ਸਾਫ ਸੁਥਰਾ ਵੀ ਲੱਗਦੇ ਨੇ ਬ ਬਗੀਚੇ ਲੱਗੇ ਪਏ ਤਾਂ ਮੈਂ ਆਪਣੇ ਘਰੇ ਹੀ ਬਾਗਬਾਨੀ ਜੀ ਤੌਰ 'ਤੇ ਸ਼ੁਰੂ ਕਰ ਲਈ ਉਹਦੇ ਵਿੱਚ ਬੂਟੇ ਫੁੱਲਦਾਰ ਨਾ ਫੁੱਲ ਐਰਾ ਵਗੈਰਾ ਲਾਉਣੀ ਸ਼ੁਰੂ ਕਰਤੀ ਬਾਅਦ ਵਿੱਚ ਹੌਲੀ ਹੌਲੀ ਮੈਨੂੰ ਇਹ ਸ਼ੌਂਕ ਜਾਗ ਪਿਆ ਕਿ ਮੈਂ ਇਸ ਨੂੰ ਆਪਣਾ ਕਾਰੋਬਾਰ ਦੇ ਰੂਪ ਵਿੱਚ ਵਧਾਵਾਂ ਜਦੋਂ ਮੈਂ ਇਸ ਦਾ ਵੱਧ ਤੋਂ ਵੱਧ ਏਰੀਆ ਵਧਾਇਆ ਗਿਆ ਜਿਵੇਂ ਵਧਾਉਣ ਤੋਂ ਬਾਅਦ ਮੈਂ ਇੱਕ ਮਾਲੀ ਰੱਖ ਲਿਆ ਅਤੇ ਉਸ ਤੋਂ ਬਾਅਦ ਮੈਂ ਵਧੀਆ ਬੀਅ ਲਿਆਂਦੇ ਉਸ ਤੋਂ ਪਨੀਰੀ ਪੈਦਾ ਕਰ ਲਈ ਤਾਂ ਉਸ ਤੋਂ ਬਾਅਦ ਬੂਟੇ ਪੈਦਾ ਹੋਣ ਲੱਗ ਗਏ ਬੂਟੇ ਬਣ ਗਏ ਫੁੱਲ ਹੋ ਗਏ ਫੁੱਲਾਂ ਤੋਂ ਬਾਅਦ ਜਦੋਂ ਕਿਵੇਂ ਵਿਆਹਾਂ ਵਿੱਚ ਡੋਲੀ ਵਾਲੀ ਕਾਰਾਂ ਦੇ ਫੁੱਲ ਸਜਾਏ ਜਾਂਦੇ ਹਨ ਜਾਂ ਫਿਰ ਕੋਈ ਕਿਵੇਂ ਕੋਈ ਗੁਰੂਆਂ ਦਾ ਤਿਉਹਾਰ ਹੋਵੇ ਉਸ ਵਿੱਚ ਫੁੱਲ ਦੀ ਵਰਖਾ ਕੀਤੀ ਜਾਂਦੀ ਹੈ ਉਹ ਮਹਿੰਗੇ ਫੁੱਲ ਵਰਤੇ ਜਾਂਦੇ ਨੇ ਤਾਂ ਉਹਦੇ ਵਿੱਚ ਮੈਨੂੰ ਵਧੀਆ ਕਮਾਈ ਹੋਣ ਲੱਗ ਗਈ ਤਾਂ ਉਹਦੇ ਵਿੱਚ ਮੇਰਾ ਕਾਰੋਬਾਰ ਵੱਧਦਾ ਫੁੱਲਦਾ ਗਿਆ ਮੈਂ ਆਪਨੇ ਬੱਚਿਆਂ ਲਈ ਹੋਰ ਲਈ ਇਹੀ ਓ ਪ੍ਰੇਰਨਾ ਚਾਹੂੰਗਾ ਜੇ ਮਿਹਨਤ ਕਰੋ ਤੇ ਅੱਗੇ ਵਧੋ